ਹੈਲੋ ਹੈਲੋ ਤੁਸੀਂ ਕੋਮਲ ਬੋਲਦੇ ਹਾਂਜੀ ਅਤੇ ਮੈਂ ਕੋਲੇਜ ਵਿੱਚ ਨਿਊ ਆਈ ਹਾਂ ਤਾਂ ਮਤਲਬ ਮੈਂ ਪਹਿਲਾਂ ਕੋਟਾ ਰਹਿੰਦਾ ਸੀ ਰਾਜਸਥਾਨ ਅਤੇ ਮੈਨੂੰ ਤੁਸੀਂ ਇਨਵਾਇਰਮੈਂਟ ਬਾਰੇ ਦੱਸੋ ਕਿੱਦਾਂ ਹੁਸ਼ਿਆਰਪੁਰ ਵਿੱਚ ਮੈਂ ਤਾਂ ਪਹਿਲੀ ਵਾਰ ਆਈ ਹਾਂ ਅੱਜ ਹਾਂਜੀ ਮੈਂ ਬੀ ਕੋਮ ਕਰਦੀ ਤੁਹਾਡੇ ਸੈਕਸ਼ਨ 'ਚ ਆ ਹਜੇ ਸਾਡੀ ਮੁਲਾਕਾਤ ਨਹੀਂ ਹੋਈ ਹਜੇ ਕੋਲੇਜ ਲੱਗੇ ਨਹੀਂ ਨਾ ਤਾਂ ਕਰਕੇ ਹਾਂਜੀ ਹਾਂਜੀ

ਹਾਂਜੀ ਸਾਡੇ ਤਾਂ ਰਾਜਸਥਾਨ ਵਿੱਚ ਮਤਲਬ ਹਰ ਵੇਲੇ ਹੀ ਸਮਰ ਹੁੰਦਾ ਹਾਂਜੀ ਗਰਮੀ ਹੁੰਦੀ ਉੱਥੇ ਸਰਦੀ ਨਹੀਂ ਪੈਂਦੀ ਹਾਂ ਹਾਂਜੀ ਹੁਣ ਮੈਂ ਇੱਥੇ ਸ਼ਿਫਟ ਹੋਈ ਹਾਂ ਨਾ ਆਫਟਰ ਪਲੱਸ ਟੂ ਉੱਥੋਂ ਹੀ ਕੋਟਾ ਰਾਜਸਥਾਨ ਤੋਂ ਹਾਂਜੀ ਮੈਂ ਇੱਥੇ ਸਟਡੀ ਲਈ ਰੱਖਿਆ ਇੱਥੇ ਮੈਂ ਹੁਸ਼ਿਆਰਪੁਰ ਇੱਥੋ ਨਿਊਕੋਟ ਤੋਂ ਹਾਂਜੀ ਅਤੇ ਤੁਸੀਂ ਅੱਛਾ ਅਤੇ ਹੋਰ ਕਿੰਨੀ ਹਾਂਜੀ ਹਾਂਜੀ ਨਹੀਂ ਮਤਲਬ ਮੈਂ ਨਾ ਸਿੱਧ ਸਾਰੇ ਹੀ ਸਮਰ ਦੇ ਕੱਪੜੇ ਲੈ ਕੇ ਆਈ ਫਿਰ ਮੈਂ ਉਸ ਹਿਸਾਬ ਨਾਲ ਕਲਾਈਮੇਟ ਬਾਰੇ ਤੁਹਾਡੇ ਤੋਂ ਪੁੱਛ ਰਹੀ ਸੀ ਫਿਰ ਮੈਂ ਤਾਂ ਕੀ ਪਰਚੇਸ ਵਗੈਰਾ ਕਰਾਂ ਹਾਂ ਹਾਂਜੀ ਅਜੇ ਮੈਨੂੰ ਦੋ ਕੁ ਦਿਨ ਹੀ ਹੋਏ ਆਏ ਨੂੰ ਤਾਂ ਮੈਨੂੰ ਉਹ ਹੀ ਦੇਖਦੀ ਸੀ ਇੱਥੇ ਠੰਡ ਬਹੁਤ ਆ ਕਦੀ ਇੱਦਾਂ ਫੀਲ ਨਹੀਂ ਕੀਤਾ ਨਾ ਇੱਦਾਂ ਵਿੰਟਰ ਹਾਂਜੀ ਹਾਂਜੀ ਹਾਂਜੀ ਉਹ ਸਮਰ ਦੇ ਤਾਂ ਮੈਂ ਲੈ ਕੇ ਆਈ ਕਿਉਂਕਿ ਉੱਥੇ ਸਮਰ ਦੇ ਹੈਗੇ ਮਿਲਦੇ ਉੱਥੇ ਵਿੰਟਰਸ ਹੁੰਦੀਆਂ ਨਹੀਂ ਤਾਂ ਕਰਕੇ ਉੱਥੇ ਵਿੰਟਰਸ ਦੇ ਕੱਪੜੇ ਮਿਲਦੇ ਨਹੀਂ ਹਾਂਜੀ ਹੋਰ ਹਜੇ ਕੋਲੇਜ ਲੱਗੇ ਨਹੀਂ ਹਜੇ ਲੱਗਣੇ ਸੀ ਹਾਂਜੀ ਹਾਂਜੀ ਚਲੋ ਮਿਲਾਂਗੇ ਫਿਰ ਆਪਾਂ ਅਤੇ ਉਹ ਕੋਲੇਜ ਮਿਲਾਂਗੇ ਅਤੇ ਹੋਰ ਤੁਹਾਡੇ ਬ੍ਰਦਰ ਸੀਸਟਰ ਹੈਗੇ ਉਹ ਵੀ ਕੋਲੇਜ ਹੀ ਪੜ੍ਹਦੇ ਅੱਛਾ ਹਾਂਜੀ ਬਾਕੀ ਮੇਰੀ ਫੈਮਲੀ ਪੂਰੀ ਕੋਟਾ 'ਚ ਹੀ ਹੈ ਮੈਂ ਇੱਥੇ ਮੈਂ ਸਟਡੀ ਬੇਸ 'ਤੇ ਆਈ ਹਾਂ ਹਾਂਜੀ ਹਾਂਜੀ ਪੀ ਜੀ ਲਈ ਸੀ ਇੱਥੇ ਹਾਂਜੀ ਹਾਂਜੀ ਵਧੀਆ ਸਾਰਾ ਰਹਿਣ ਸਹਿਣ ਵੀ ਸਾਰਾ ਵਧੀਆ ਜਿਹੜੇ ਮਕਾਨ ਮਾਲਿਕ ਆ ਰੋਟੀ ਪਾਣੀ ਵੀ ਵਧੀਆ ਦਿੰਦੇ ਸਾਫ਼ ਸਫਾਈ ਵੀ ਆ ਸਭ ਕੁਛ ਮਤਲਬ ਇੱਥੇ ਘਰ ਵਾਲਾ ਹੀ ਫੀਲ ਆਉਂਦਾ ਹਾਂਜੀ ਹਾਂਜੀ ਇਹ ਹੀ ਬੰਦਾ ਬਾਹਰ ਆ ਕੇ ਸੋਚਦਾ ਆ ਹਾਂਜੀ ਹਾਂਜੀ ਹਾਂਜੀ ਇੱਥੇ ਤਿੰਨ ਹਜ਼ਾਰ ਹਾਂਜੀ ਹਾਂਜੀ ਹਾਂਜੀ ਸਾਫ਼ ਸਫਾਈ ਸਭ ਵਧੀਆ ਚਲੋ ਫਿਰ ਮਿਲਾਂਗੇ ਕੋਲੇਜ ਹਾਂਜੀ ਓਕੇ ਬਾਏ